ਪੰਦਰਾਂ ਅਗਸਤ ਉੱਨੀ ਸੌ ਸੱਠ ਤੇਰ੍ਹਾਂ ਨਵੰਬਰ ਉੱਨੀ ਸੌ ਵੀਹ ਦਸ ਅਗਸਤ ਦੋ ਹਜ਼ਾਰ ਪੰਜ ਤੇਰ੍ਹਾਂ ਨਵੰਬਰ ਦੋ ਹਜ਼ਾਰ ਛੇ ਬਾਰਾਂ ਅਗਸਤ ਉੱਨੀ ਸੌ ਨੜ੍ਹਿਨਵੇਂ